ਸਾਡੇ ਇਲਾਕੇ ਵਿੱਚ ਇੱਕ ਬਹੁਤ ਵੱਡਾ ਗਰਾਊਂਡ ਹੈ ਜੋ ਕਿ ਅਸੀਂ ਅੱਗੇ ਜਿਹੜੀ ਸਾਡੀ ਐੱਮ ਐੱਲ ਏ ਉਹਨੂੰ ਸਿਫਾਰਿਸ਼ ਕੀਤੀ ਸੀਗੀ ਕਿ ਇੱਥੇ ਪਾਰਕ ਬਣਾ ਦਿੱਤੀ ਜਾਵੇ ਤਾਂ ਕਿ ਬਜ਼ੁਰਗ ਔਰ ਬੱਚੇ ਇੱਥੇ ਆ ਕੇ ਖੇਡ ਸਕਣ ਕਿਉਂਕਿ ਗਲ਼ੀਆਂ ਦੇ ਵਿੱਚ ਪ੍ਰੋਪਰਲੀ ਨਾ ਤਾਂ ਖੇਡਿਆ ਜਾਂਦਾ ਨਾ ਹੀ ਘੁੰਮ ਫਿਰ ਹੁੰਦਾ ਹੈ